ਹੈਲੋ ਹੈਲੋ ਭਾ ਜੀ ਸਤਿ ਸ਼੍ਰੀ ਅਕਾਲ ਭਾ ਜੀ ਸਤਿ ਸ਼੍ਰੀ ਅਕਾਲ ਭਾ ਜੀ ਹੋਰ ਹੋਰ ਭਾ ਜੀ ਕਿਆ ਕਰਦੇ ਕਿੱਦਾਂ ਬੱਚੇ ਪਰਿਵਾਰ ਠੀਕ ਆ ਜੀ ਠੀਕ ਠੀਕ ਆ ਹਾਂਜੀ ਮੈਂ ਪੁੱਛਣਾ ਜੀ ਸਕੂਲ ਨਵਾਂ ਸ਼ਹਿਰ ਏਰੀਏ 'ਚ ਸਕੂਲ ਕਿਹੜਾ ਵਧੀਆ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਆ ਠੀਕ ਆ ਜੀ ਠੀਕ ਆ ਜੀ ਠੀਕ ਠੀ ਠੀਕ ਆ ਠੀਕ ਆ ਜੀ ਅੱਛਾ ਜੀ ਹੋਰ ਜੀ ਫੀਸ ਫੂਸ ਕਿੱਦਾਂ ਜੀ ਇਹਨਾਂ ਸਕੂਲਾਂ 'ਚ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਮੈਨੂੰ ਦੱਸੋ ਭਾ ਜੀ ਜਿਹੜਾ ਐਜੂਕੇਸ਼ਨ ਸਿਸਟਮ 'ਚ ਵਧੀਆ ਸਕੂਲ ਹੈ ਉਹ ਕਿਹੜਾ ਜੀ ਅੱਛਾ ਜੀ ਵਧੀਆ ਜਣੀ ਗੇਮਿੰਗ ਗੂਮਿੰਗ ਹੈਂ ਅੱਛਾ ਅੱਛਾ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਜੀ ਚੱਲੋ ਜੀ ਬਹੁਤ ਵਧੀਆ ਧੰਨਵਾਦ ਜਾਣਕਾਰੀ ਲਈ ਓਕੇ ਓਕੇ ਓਕੇ ਓਕੇ ਵੈਲਕਮ ਵੈਲਕਮ ਥੈਂਕ ਯੂ